ਹੈਲੋ ਹੈਲੋ ਹਾਂਜੀ ਨਮਸਤੇ ਜੀ ਹਾਂਜੀ ਹਾਂਜੀ

ਠੀਕ ਹੈ ਜੀ ਇੱਥੋਂ ਤਾਂ ਦੇਖੋ ਪਹਿਲਾਂ ਤਾਂ ਸਾਨੂੰ ਵਧੀਆ ਮਤਲਬ ਕਿ ਆਪਣੇ ਹਨੂਮਾਨ ਚੌਂਕ ਹੈ ਕਾਫੀ ਅੱਛੇ ਦੁਕਾਨਾਂ ਆ ਜਿਹਦੇ ਮਤਲਬ ਕਿ ਸਰਪੰਚ ਡੇਅਰੀ ਹੈ ਔਰ ਬਾਜਵਾ ਡੇਅਰੀ ਹੈ ਹੈ ਨਾ ਪੂਰੀਆਂ ਦੀ ਡੇਅਰੀ ਹਾਂ ਬਹੁਤ ਹੀ ਵਧੀਆ ਤੁਹਾਨੂੰ ਉਥੋਂ ਮਤਲਬ ਕਿ ਮਿਲ ਸਕਦਾ ਦੁੱਧ ਜਿਹਦੇ ਵਿੱਚੋਂ ਕੀ ਮਤਲਬ ਪ੍ਰੋਟੀਨ ਪੂਰਾ ਕੋਈ ਉਹਨਾਂ ਨੇ ਮਿਲਾਵਟ ਨਹੀਂ ਆ ਉਹਦੇ 'ਚ ਤੁਹਾਡੀ ਸਿਹਤ ਵਾਸਤੇ ਵੀ ਹਾਂਜੀ ਨਹੀਂ ਨਹੀਂ ਨਹੀਂ ਕੋਈ ਫੈਟ ਨਹੀਂ ਉਹ ਕੱਢਦੇ ਪਿਓਰ ਦੁੱਧ ਮਤਲਬ ਕਿ ਉਹ ਦਿੰਦੇ ਹੈ ਹਾਂ ਹਾਂਜੀ ਹਾਂਜੀ ਹਾਂਜੀ ਘਰ 'ਚ ਡੇਅਰੀ ਮਤਲਬ ਕਿ ਹੈਗੀ ਆ ਸਾਡੀ ਆਪਣੇ ਛੋਟੀ ਮਾਤਾ ਮੰਦਰ ਵੱਲ ਵੀ ਹੈ ਹੋਰ ਵੀ ਮਤਲਬ ਹੈ ਹਾਂਜੀ ਬ੍ਰਹਮਪੁਰ ਰੋਡ ਵੱਲ ਵੀ ਹੈ ਜੇ ਤੁਸੀਂ ਉੱਥੋਂ ਲੈਣਾ ਚਾਹੋ ਤਾਂ ਉੱਥੋਂ ਵੀ ਤੁਸੀਂ ਲੈ ਸਕਦੇ ਹੋ ਉਹ ਜੇ ਤੁਸੀਂ ਸੀਟੀ 'ਚ ਮਤਲਬ ਕਿ ਇੱਥੋਂ ਲੈਣਾ ਚਾਹੁੰਦੇ ਹੋ ਅਤੇ ਇੱਥੋਂ ਵੀ ਤੁਹਾਨੂੰ ਬਹੁਤ ਵਧੀਆ ਮਤਲਬ ਕਿ ਮਿਲ ਸਕਦਾ ਔਰ ਮਤਲਬ ਕਿ ਆਪਣੇ ਸਰੀਰ ਵਾਸਤੇ ਵੀ ਬਹੁਤ ਵਧੀਆ ਹਾਂਜੀ ਸਭ ਕੁਛ ਹੈ ਜੀ ਦਹੀਂ ਹੈ ਪਨੀਰ ਹੈ ਔਰ ਪਿਓਰ ਹੈ ਕੋਈ ਮਿਲਾਵਟ ਨਹੀਂ ਹੈ ਕੋਈ ਫੈਟ ਨਹੀਂ ਉਹਨਾਂ ਨੇ ਕੱਢੀ ਵੀ ਕੋਈ ਕੁਛ ਨਹੀਂ ਹੈ ਇੱਕਦਮ ਫਰੈਸ਼ ਤੁਹਾਨੂੰ ਸਮਾਨ ਉੱਥੋਂ ਮਤਲਬ ਕਿ ਮਿਲੇਗਾ ਹਾਂਜੀ ਵੇਰਕੇ ਦਾ ਵੀ ਮਿਲ ਜਾਏਗਾ ਤੁਹਾਨੂੰ ਅਮੂਲ ਦਾ ਵੀ ਹੈ ਵੇਰਕੇ ਦਾ ਵੀ ਹੈ ਹਾਂਜੀ ਤੁਹਾਨੂੰ ਕੋਈ ਮਤਲਬ ਤੁਸੀਂ ਨਿਊ ਆਏ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ ਇੱਥੇ ਹਰ ਚੀਜ਼ ਮਤਲਬ ਵੀ ਤੁਹਾਨੂੰ ਵਧੀਆ ਹੀ ਮਿਲੇਗੀ ਹਾਂਜੀ ਹਾਂ ਹੋਰ ਦਹੀਂ ਮੱਖਣ ਲੱਸੀ ਵਗੈਰਾ ਮੱਖਣ ਵਗੈਰਾ ਸਭ ਕੁਛ ਤੁਹਾਨੂੰ ਮਿਲੇਗਾ ਔਰ ਪਿਓਰ ਹੀ ਮਿਲੇਗਾ ਕੋਈ ਮਿਲਾਵਟ ਵਾਲਾ ਨਹੀਂ ਹੈ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਕੋਈ ਨਹੀਂ ਕੋਈ ਨਹੀਂ ਤੁਸੀਂ ਬੇਝਿਜਕ ਹੋ ਕੇ ਉੱਥੇ ਜਾਓ ਤੁਹਾਨੂੰ ਕੋਈ ਮਿਲਾਵਟ ਵਾਲੀ ਚੀਜ਼ ਨਹੀਂ ਮਿਲੇਗੀ ਠੀਕ ਹੈ ਜੀ ਓਕੇ ਬਾਏ